ਸਤਿ ਸ਼੍ਰੀ ਅਕਾਲ ਜੀ ਜਿਵੇਂ ਆਪਾਂ ਜਾਣਦੇ ਹਾਂ ਪੰਜਾਬੀ ਜਿਹੜਾ ਡਾਂਸ ਆ ਬਹੁਤ ਬਹੁਤ ਜ਼ਿਆਦਾ ਜਿਹੜਾ ਹੈਗਾ ਫੇਮਸ ਭੰਗੜਾ ਗਿੱਧਾ ਹਰੇਕ ਵਿਆਹ ਸ਼ਾਦੀ 'ਚ ਦੁਨੀਆਂ ਦੇ ਹਰੇਕ ਕੋਨੇ 'ਚ ਹਰੇਕ ਵਿਆਹ ਸ਼ਾਦੀ 'ਚ ਪੰਜਾਬੀ ਸੰਗੀਤ ਚੱਲਦਾ ਅਤੇ ਆਪਾਂ ਜਾਣਦੇ ਹਾਂ ਵੀ ਆਪਣੇ ਬਹੁਤ ਪੁਰਾਣੇ ਟਾਈਮ 'ਤੇ ਹੰਸ ਰਾਜ ਹੰਸ ਜੀ ਦਾ ਬਹੁਤ ਪਾਪੂਲਰ ਸੋਂਗ ਆ ਉਹ ਨੂੰ ਦਿਲ ਵੀ ਦਿਆਂਗੇ ਜਿਹੜੀ ਨੱਚੂਗੀ ਸਾਡੇ ਨਾਲ ਉਹ ਸਾਡੇ ਮੰਮੀ ਡੈਡੀ ਦੇ ਵਿਆਹਾਂ ਤੋਂ ਲੈ ਕੇ ਸਾਡੇ ਵਿਆਹਾਂ ਦੀਆਂ ਮੂਵੀਆਂ ਵਿੱਚ ਵੀ ਉਹ ਗਾਣਾ ਬਹੁਤ ਚੱਲਿਆ ਕਿਉਂਕਿ ਉਹ ਗਾਣੇ ਦੀ ਬਹੁਤ ਦੁਨੀਆਂ ਨੱਚਦੀ ਆ ਅਤੇ ਉਹ ਹੁਣ ਵੀ ਪੂਰਾ ਉਹ ਹੀ ਹੰਸ ਰਾਜ ਜੀ ਦਾ ਗਾਣਾ ਚੱਲਦਾ ਅਤੇ ਲੋਕ ਉਹ 'ਤੇ ਬਹੁਤ ਜ਼ਿਆਦਾ ਡਾਂਸ ਕਰਦੇ ਆ ਭੰਗੜੇ ਭੰਗੜਾ ਪਾਉਂਦੇ ਆ ਅਤੇ ਹਰੇਕ ਵਿਆਹ ਸ਼ਾਦੀ ਜੇ ਫੇਮਸ ਅਤੇ ਪ੍ਰਸਿੱਧ ਡਾਂਸ ਆ ਭੰਗੜਾ ਅਤੇ ਗਿੱਧਾ ਹੁਣ ਆਪਾਂ ਜਾਣਦੇ ਹਾਂ ਵੀ ਭੰਗੜਾ ਭੰਗੜੇ ਨੂੰ ਲੋਕ ਹੈ ਨਾ ਆਪਣੀ ਫਿਜੀਕਲ ਫਿਟਨੈਸ 'ਚ ਵੀ ਯੂਜ ਕਰਦੇ ਕਿਸੇ ਵੀ ਜਿੰਮ 'ਚ ਜਾ ਵੜੋ ਕਿਸੇ ਵੀ ਫਿਜੀਕਲ ਫਿਟਨਰ ਦੀ ਕਲਾਸ ਲਾ ਲੈ ਕੇ ਆਓ ਉੱਥੇ ਆਪਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਭੰਗੜਾ ਹੀ ਪਾਉਣਾ ਸਿਖਾਉਂਦੇ ਆ ਭੰਗੜੇ ਦੇ ਛੋਟੇ ਸਟੈਪਾਂ ਨੂੰ ਚੱਲ ਕੇ ਭੰਗੜੇ ਦੇ ਵੱਡੇ ਸਟੈਪਾਂ ਤੱਕ ਲੈ ਕੇ ਜਾਂਦੇ ਹੈਗੇ ਜਿਵੇਂ ਤਾਲ ਝੂੰਮਰ ਸਾਰੇ ਸਟੈਪਸ ਨੇ ਜਿਹੜੇ ਭੰਗੜੇ ਦੇ ਜਿੰਨੇ ਵੀ ਵੱਡੇ ਸਟੈਪ ਜਾਂ ਲੈਗਸ ਨਾਲ ਬਾਹਾਂ ਜਿਹੜੇ ਆਪਣੇ ਸਰੀਰ ਨੂੰ ਲਚਕੀਲਾਪਣ ਪ੍ਰਾਪਤ ਕਰਦੇ ਆ ਅਤੇ ਇਸ ਨਾਲ ਆਪਣਾ ਜਿਹੜਾ ਸਰੀਰ ਆ ਹੈ ਨਾ ਆਪਣੀ ਫਿਜੀਕਲ ਫਿਟਨੈਸ ਵੀ ਬਹੁਤ ਵਧੀਆ ਅਤੇ ਭੰਗੜਾ ਪਾਉਣ ਨਾਲ ਜਿਹੜਾ ਆਪਣਾ ਹੈ ਨਾ ਸਾਰੀ ਸਾਹ ਪ੍ਰਣਾਲੀ ਸਾਹ ਪ੍ਰਕਿਰਿਆ ਆਪਣੇ ਸਰੀਰ ਦੀ ਹਰੇਕ ਪ੍ਰਕਿਰਿਆ ਜਿਹੜੀ ਹੈ ਬਹੁਤ ਵਧੀਆ ਚਲਦੀ ਹੈ ਆਪਣਾ ਜਿਹੜਾ ਆਪਣਾ ਸਰੀਰ ਆ ਉਹ ਪੂਰਾ ਅਰੋਗਿਕ ਹੋ ਜਾਂਦਾ ਮਤਲਬ ਆਪਾਂ ਨੂੰ ਕੋਈ ਵੀ ਰੋਗ ਨਹੀਂ ਲੱਗਦਾ ਇਸ ਲਈ ਹਰ ਇੱਕ ਫਿਟਨਸ ਕਲਾਸ 'ਚ ਵੀ ਭੰਗੜਾ ਕੀਤਾ ਜਾਂਦਾ ਥੈਂਕ ਯੂ